ਪੇਂਡੂ ਔਰਤਾਂ ਅਤੇ ਕੰਮ ਕਰਨ ਵਾਲੀਆਂ ਔਰਤਾਂ ਅਤੇ ਘਰੇਲੂ ਔਰਤਾਂ ਲਈ ਵੱਖ ਵੱਖ ਨੀਤੀਆਂ ਉਪਲੱਬਧ ਤਾਂ ਨਹੀਂ ਕੀਤੀਆਂ ਗਈਆਂ ਲੇਕਿਨ ਹਾਲਾਤਾਂ ਦੇ ਮੁਤਾਬਿਕ ਇਨ੍ਹਾਂ ਨੇ ਆਪਣੇ ਆਪਣੇ ਕੰਮ ਚੁਣ ਲਏ ਹਨ ਪੇਂਡੂ ਔਰਤਾਂ ਸਰੀਰਿਕ ਰੂਪ ਵਿੱਚ ਮਜ਼ਬੂਤ ਹੁੰਦੀਆਂ ਹਨ ਉਨ੍ਹਾਂ ਨੂੰ ਕੰਮ ਕਰਨ ਦੀ ਆਦਤ ਵੀ ਹੁੰਦੀ ਹੈ ਕਿਉਂਕਿ ਉਹ ਘਰ ਦੇ ਕੰਮ ਦੇ ਨਾਲ ਨਾਲ ਖੇਤਾਂ ਵਿੱਚ ਵੀ ਜਾਂਦੀਆਂ ਹਨ ਕੰਮ ਕਰਦੀਆਂ ਹਨ ਇਸ ਕਰਕੇ ਉਨ੍ਹਾਂ ਦਾ ਵਜੂਦ ਅੱਛਾ ਹੋ ਜਾਂਦਾ ਹੈ ਜਿੰਨਾ ਕੰਮ ਕੀਤਾ ਜਾਂਦਾ ਹੈ ਭੁੱਖ ਵੀ ਓਸੇ ਅਨੁਸਾਰ ਹੀ ਲੱਗਦੀ ਹੈ ਇਸ ਲਈ ਉਨ੍ਹਾਂ ਦਾ ਖਾਣ ਪੀਣ ਸਾਦਾ ਹੋਣ ਦੇ ਬਾਵਜੂਦ ਵੀ ਬਹੁਤ ਮਜ਼ਬੂਤ ਕਿਸਮ ਦਾ ਹੁੰਦਾ ਹੈ ਜਿਸ ਕਰਕੇ ਉਹ ਹਰਾ ਭੋਜਨ ਜ਼ਿਆਦਾ ਪਸੰਦ ਕਰਦੀਆਂ ਹਨ ਬਾਹਰ ਖੇਤਾਂ 'ਚ ਉਪਜਦੀਆਂ ਚੀਜ਼ਾਂ ਜਿਸ ਤਰ੍ਹਾਂ ਕਰੇਲੇ ਜਾਂ ਹੋਰ ਇਸ ਨਾਲ ਦੀਆਂ ਹਰੀਆਂ ਸਬਜ਼ੀਆਂ ਉਹ ਜ਼ਿਆਦਾ ਖਾ ਕੇ ਖੁਸ਼ ਰਹਿੰਦੀਆਂ ਹਨ ਇਸ ਕਰਕੇ ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਸ਼ਹਿਰ ਦੀਆਂ ਔਰਤਾਂ ਨਾਲੋਂ ਇੱਕ ਤਰ੍ਹਾਂ ਦਾ ਵੱਖ ਹੁੰਦਾ ਹੈ ਦੂਜੇ ਪਾਸੇ ਜੋ ਘਰੇਲੂ ਔਰਤਾਂ ਹੁੰਦੀਆਂ ਹਨ ਸ਼ਹਿਰ ਵਾਲੀਆਂ ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਹਲਕਾ ਰਹਿੰਦਾ ਹੈ ਔਰ ਜ਼ਿਆਦਾ ਬੈਠਣ ਉੱਠਣ ਵਿੱਚ ਵਿਸ਼ਵਾਸ ਹੋ ਜਾਂਦਾ ਹੈ ਜਿਸ ਕਰਕੇ ਉਹ ਇੰਨਾਂ ਕੰਮ ਨਹੀਂ ਕਰ ਸਕਦੀਆਂ ਅੱਜ ਦੇ ਤਰੀਕੇ ਮੁਤਾਬਿਕ ਜਾਂ ਅੱਜ ਦੇ ਮਾਹੌਲ ਦੇ ਮੁਤਾਬਿਕ ਬਹੁਤ ਸਾਰੀਆਂ ਘਰੇਲੂ ਔਰਤਾਂ ਘਰੇਲੂ ਕੰਮ ਕਰਨ ਦੇ ਬਾਵਜੂਦ ਘਰੇਲੂ ਦੇ ਨਾਂ 'ਤੇ ਨੌਕਰੀ ਵੀ ਕਰਦੀਆਂ ਹਨ ਜਾਂ ਘਰਾਂ ਦੇ ਅੰਦਰ ਹੀ ਪੈਸੇ ਕਮਾਉਣ ਦੇ ਸਾਧਨ ਰੱਖੇ ਹੋਏ ਹਨ ਜਿਨ੍ਹਾਂ ਦਾ ਕਰਕੇ ਉਹ ਕੰਮ ਕਰਦੀਆਂ ਹਨ ਘਰੇਲੂ ਕੰਮ ਕਰਨ ਵਾਸਤੇ ਬਾਹਰ ਤੋਂ ਕੋਈ ਲੜਕੀਆਂ ਰੱਖ ਲੈਂਦੀਆਂ ਹਨ ਜਿਸ ਕਰਕੇ ਸਰੀਰ ਸਰੀਰ ਦੇ ਵਿੱਚ ਜਿਸ ਚੀਜ ਦੀ ਲੋੜ ਹੈ ਉਹ ਕਮੀ ਆ ਜਾਂਦੀ ਹੈ ਦਿਮਾਗ 'ਤੇ ਟੈਨਸ਼ਨ ਜੋ ਬਹੁਤ ਰਹਿਣ ਲੱਗ ਜਾਂਦੀ ਹੈ ਇਸ ਕਰਕੇ ਉਹ ਸਰੀਰ ਵਜੋਂ ਕਮਜ਼ੋਰ ਹੋ ਜਾਂਦੀਆਂ ਹਨ